ਹਾਂਜੀ ਇੱਥੇ ਆਪਾਂ ਭੰਗੜੇ ਦੇ ਪ੍ਰਦਰਸ਼ਨ ਦੇ ਲਈ ਜਿਹੜਾ ਪਹਿਨਿਆ ਜਾਣ ਵਾਲਾ ਪਹਿਰਾਵਾ ਨਾ ਇਹ ਬਹੁਤ ਹੀ ਖਾਸ ਤਰੀਕੇ ਦੇ ਨਾਲ ਚੁਣਿਆ ਜਾਂਦਾ ਹੈਗਾ ਇਹ ਪਹਿਰਾਵਾ ਜਿਹੜਾ ਸਿਰਫ ਆਪਣੇ ਨਾਚ ਦੀ ਸੁੰਦਰਤਾ ਨੂੰ ਨਹੀਂ ਵਧਾਉਂਦਾ ਸਗੋਂ ਨਾਚ ਕਰਨ ਵਾਲਿਆਂ ਦੀ ਵੀ ਇੱਕ ਵਿਸ਼ੇਸ਼ ਉਹਨਾਂ ਨੂੰ ਵੀ ਇੱਕ ਵਿਸ਼ੇਸ਼ ਪਹਿਚਾਣ ਦਿੰਦਾ ਹੈਗਾ ਆਮ ਤੌਰ 'ਤੇ ਭੰਗੜੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਪਹਿਰਾਵੇ ਪਹਿਨੇ ਜਾਂਦੇ ਨੇ ਮਰਦ ਅੱਡ ਤਰ੍ਹਾਂ ਦੇ ਪਹਿਨਦੇ ਨੇ ਅਤੇ ਔਰਤਾਂ ਅੱਡ ਤਰ੍ਹਾਂ ਦੀਆਂ ਪਹਿਰਾਵਾਂ ਪਹਿਨਦੀਆਂ ਨੇ ਜੇ ਆਪਾਂ ਮਰਦਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਕੁੜਤਾ ਹੈਗਾ ਚਮਕਦਾਰ ਸੂਟ ਹੈਗਾ ਜਿਸ ਵਿੱਚ ਕਢਾਈ ਅਤੇ ਬੂਟੇ ਵੀ ਹੁੰਦੇ ਹਨ ਪਜ਼ਾਮਾ ਉਹਨਾਂ ਦਾ ਆਮ ਤੌਰ 'ਤੇ ਚਿੱਟਾ ਜਿਹਾ ਕਰੀਮ ਹੁੰਦਾ ਹੈਗਾ ਕਈ ਵਾਰੀ ਆਪਾਂ ਦੇਖਿਆ ਭੰਗੜੇ ਵਾਲੇ ਹੈਨਾ ਚਾਦਰਾ ਵੀ ਲਾਉਂਦੇ ਨੇ ਚਾਦਰੇ ਨਾਲ ਬਹੁਤ ਵਧੀਆ ਫੱਬਦੇ ਨੇ ਅਤੇ ਬਹੁਤ ਸੋਹਣੀਆਂ ਜੁੱਤੀਆਂ ਹੁੰਦੀਆਂ ਉਹਨਾਂ ਦੀਆਂ ਖੁੱਸੇ ਜਾਂ ਤਿੱਲੇਦਾਰ ਜੁੱਤੀਆਂ ਪਹਿਨਦੇ ਨੇ ਉਹ ਅਤੇ ਪਗੜੀ ਰੰਗੀਨ ਪਗੜੀ ਸਿਰ ਨੂੰ ਜਿਹੜੇ ਕੀ ਹੈ ਤੁਰਲੇ ਵਾਲੀ ਪੱਗ ਬੰਨਦੇ ਨੇ ਗੱਲ 'ਚ ਕੈਂਠਾ ਪਾਇਆ ਹੁੰਦਾ ਨੱਥੀਆਂ ਪਾਈਆਂ ਹੁੰਦੀਆਂ ਇਹਨਾਂ ਵੀ ਐਨ ਪੂਰੇ ਘੈਂਟ ਲੱਗਦੇ ਆ ਦੇਖਣ ਨੂੰ ਬੰਦੇ ਅਤੇ ਜੇ ਹੁਣ ਆਪਾਂ ਔਰਤਾਂ ਦੀ ਗੱਲ ਕਰਦੇ ਹਾਂ ਤਾਂ ਔਰਤਾਂ ਦਾ ਪਹਿਰਾਵਾ ਤਾਂ ਇਹ ਵੀ ਪੂਰਾ ਫੱਟੇ ਚੱਕਦਾ ਹੁੰਦਾ ਹੈਗਾ ਉਹਨਾਂ ਦਾ ਸੂਟ ਦੇਖੀਏ ਪੂਰਾ ਐਏ ਗੈਗੜ ਚਮਕਦਾ ਸੂਟ ਪਾਇਆ ਹੁੰਦਾ ਹੈਗਾ ਗੋਟੇ ਅਤੇ ਜਰੀ ਦੇ ਨਾਲ ਕੱਢਿਆ ਹੁੰਦਾ ਪੂਰਾ ਅਤੇ ਚੂੜੀਆਂ ਪਾਈਆਂ ਹੁੰਦੀਆਂ ਉਹਨਾਂ ਦੇ ਰੰਗ ਬਿਰੰਗੀਆਂ ਜਿਹੜੀਆਂ ਪੂਰਾ ਖੜਕਾ ਕਰਨ ਕੰਨਾਂ ਦੇ ਵਿੱਚ ਝੂੰਮਕੇ ਪਿੱਪਲ ਪੱਤੀਆਂ ਵੱਡੇ ਵੱਡੇ ਲੋਟਨ ਪਾਏ ਹੁੰਦੇ ਨੇ ਜਿਹੜੇ ਉਹਨਾਂ ਦੀ ਸੁੰਦਰਤਾ ਨੂੰ ਹੋਰ ਚਾਰ ਚੰਨ ਲਾ ਦਿੰਦੇ ਨੇ ਤੇ ਜੁੱਤੀਆਂ ਦਾ ਤਾਂ ਕੋਈ ਅੰਤ ਨੀ ਜੁੱਤੀਆਂ ਜਰੀ ਦੀਆਂ ਕੱਢੀਆਂ ਹੋਈਆਂ ਹੁੰਦੀਆਂ ਨੇ ਅਤੇ ਤਾਂਹੀਓ ਤਾਂ ਇਹ ਕਿਹਾ ਜਾਂਦਾ ਜਿਹੜੀਆਂ ਇਹ ਪੋਸ਼ਾਕਾਂ ਨੇ ਨਾ ਇਹਨਾਂ ਭੰਗੜਾ ਕਰਨ ਵਾਲਿਆਂ ਨੂੰ ਡਾਂਸ ਕਰਨ ਵਾਲਿਆਂ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾ ਦਿੰਦੀਆਂ ਨੇ ਕਿਉਂ ਬਣਾ ਦਿੰਦੀਆਂ ਨੇ ਕਿਉਂਕਿ ਇਹਨਾਂ ਦੇ ਜਿਹੜੇ ਚਮਕਦਾਰ ਰੰਗ ਇੰਨੇ ਜ਼ਿਆਦਾ ਵਧੀਆ ਹੁੰਦੇ ਨੇ ਕੀ ਜਿਹੜੀਆਂ ਉਹ ਜਦੋਂ ਉਹ ਭੰਗੜਾ ਪਾਉਂਦੇ ਨੇ ਜਾਂ ਗਿੱਧਾ ਪਾਉਂਦੇ ਨੇ ਅਤੇ ਉਹ ਜਿਹੜੇ ਕੀ ਹੈ ਉਹਨਾਂ ਦੀਆਂ ਹਰਕਤਾਂ ਦੇ ਨਾਲ ਉਹ ਜਿਹੜੇ ਕੱਪੜੇ ਹੈ ਉਹਨਾਂ ਦੇ ਐਨ ਪੂਰੇ ਘੈਂਟ ਲੱਗਦੇ ਨੇ ਹਰ ਇੱਕ ਜਿਹੜੀ ਉਹ ਮੁਦਰਾਂ ਕਰਦੇ ਨੇ ਤਾਂ ਬਹੁਤ ਵਧੀਆ ਲੱਗਦੀ ਹੈ ਅਤੇ ਕਢਾਈ ਅਤੇ ਬੂਟਿਆਂ ਦੇ ਪਹਿਰਾਵੇ ਹੋਰ ਵੀ ਖੂਬਸੂਰਤ ਭਾਵ ਜਦੋਂ ਉਹ ਨੱਚਦੇ ਆ ਤਾਂ ਉਹਨਾਂ ਦੀ ਸ਼ਖਸ਼ੀਅਤ ਆ ਨਾ ਵੱਖਰੇ ਤਰ੍ਹਾਂ ਦੀ ਹੀ ਨਜ਼ਰ ਆਉਂਦੀ ਹੈਗੀ ਤਾਂ ਜਿਹੜੀ ਇਹ ਕੀ ਹੈ ਇਸ ਲਈ ਜਿਹੜਾ ਕੀ ਹੈਗਾ ਜਿਹੜਾ ਔਰਤਾਂ ਚੂੜੀਆਂ ਝੂੰਮਕੇ ਸਾਰਾ ਕੁਛ ਪਾਉਂਦੀਆਂ ਨੇ ਇਹ ਸਾਰਾ ਕੁਛ ਇਹੀ ਹੈਗਾ ਵੀ ਜਿਹੜਾ ਮਰਦ ਵੀ ਜਿਵੇਂ ਆਪਦਾ ਗਹਿਣੇ ਗੁਹਣੇ ਸਾਰਾ ਕੁਛ ਪਾਉਂਦੇ ਨੇ ਇਹ ਪਾ ਕੇ ਉਹ ਇੰਨੇ ਜ਼ਿਆਦਾ ਫੱਬਦੇ ਨੇ ਜਿਹੜੇ ਭੰਗੜੇ ਨੂੰ ਹੋਰ ਵੀ ਚਾਰ ਚੰਦ ਲੱਗ ਜਾਂਦੇ ਨੇ ਭੰਗੜੇ ਦੀਆਂ ਹਰਕਤਾਂ ਨੇ ਉਹ ਕਰਦੇ ਨੇ ਆਪਦੇ ਸਟੈਪ ਕਰਦੇ ਨੇ ਅਤੇ ਉਹਨਾਂ ਦੇ ਇਹਨਾਂ ਦੇ ਜਿਹੜੇ ਆਹਾ ਸਾਰਾ ਕੁਛ ਪਾਇਆ ਹੁੰਦਾ ਉਹਦੇ ਨਾਲ ਉਹਨੂੰ ਹੋਰ ਵੀ ਜ਼ਿਆਦਾ ਉਹ ਵਧੀਆ ਲੱਗ ਜਾਂਦਾ ਹੈਗਾ ਹਾਂਜੀ ਬਸ ਮੈਂ ਇੱਥੇ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਸੀਗਾ ਜੋ ਮੈਂ ਦੱਸ ਚੁੱਕਿਆ ਹੈਗਾ ਵੀ ਭੰਗੜੇ ਦਾ ਪ੍ਰਦਰਸ਼ਨ ਹੈਗਾ ਜਿਹੜਾ ਆਮ ਤੌਰ 'ਤੇ ਉਹਦੇ ਵਿੱਚ ਜਿਹੜਾ ਪਹਿਰਾਵਾ ਪਾਇਆ ਜਾਂਦਾ ਹੈ ਉਹੀ ਭੰਗੜੇ ਨੂੰ ਚਾਰ ਚੰਨ ਲਾ ਦਿੰਦਾ ਹੈਗਾ ਜੀ